ਸਤਿ ਸ਼੍ਰੀ ਅਕਾਲ ਸਰ ਮੇਰਾ ਔਡਰ ਜੋ ਕਿ ਮੈਂ ਦੀਪਿਕਾ ਦੇ ਨਾਮ 'ਤੇ ਕੀਤਾ ਹੋਇਆ ਸੀ ਜਿਸ ਵਿੱਚ ਕਿ ਮੈਂ ਫਰਾਈਜ ਦੋ ਬਰਗਰ ਇਕ ਪੀਜ਼ਾ ਔਰ ਦੋ ਕੋਲ ਡ੍ਰਿੰਕਸ ਮੰਗਾਈਆਂ ਹੋਈਆਂ ਸਨ ਸਰ ਜਿਸ ਟਾਈਮ 'ਤੇ ਮੈਨੂੰ ਇਹ ਔਡਰ ਮਿਲਿਆ ਹੀਗਾ ਉਸ ਟਾਈਮ 'ਤੇ ਜੋ ਕਿ ਕੋਲ ਡਰਿੰਗ ਸੀਗੀ ਉਹ ਪੂਰੀ ਬਾਹਰ ਨਿਕਲ ਗਈ ਸੀ ਆਪਣੀ ਪੈਕਜਿੰਗ ਤੋਂ ਜਿਸ ਕਰਕੇ ਮੇਰੇ ਸਾਰੇ ਬਰਗਰ ਸੋਗੀ ਹੋ ਗਏ ਪੂਰੇ ਖਰਾਬ ਹੋ ਚੁੱਕੇ ਸਨ ਉਸਦਾ ਬੰਨ ਵੀ ਪੂਰਾ ਕੋਲ ਡਰਿੰਕ ਕਰਕੇ ਖਰਾਬ ਹੋ ਗਿਆ ਸੀ ਔਰ ਫਰਾਈਜ ਵੀ ਪੂਰੇ ਬਿਲਕੁਲ ਸੋਗੀ ਹੋ ਚੁੱਕੇ ਸਨ ਔਰ ਮੇਰੇ ਪੀਜੇ ਦੀ ਪੈਕਜਿੰਗ ਵਿੱਚ ਵੀ ਥੋੜ੍ਹੀ ਕੋਲ ਡਰਿੰਕ ਚੱਲ ਗਈ ਸੀ ਇਸ ਕਰਕੇ ਪਲੀਜ਼ ਮੈਨੂੰ ਇਸ ਔਡਰ ਕਰਕੇ ਬਹੁਤ ਜ਼ਿਆਦਾ ਪਰੇਸ਼ਾਨੀ ਹੋ ਰਹੀ ਹੈ ਔਰ ਇਹ ਔਡਰ ਮੈਨੂੰ ਬਹੁਤ ਹੀ ਗੰਦੀ ਹਾਲਤ ਵਿੱਚ ਪ੍ਰਾਪਤ ਹੋਇਆ ਹੈ ਇਸ ਕਰਕੇ ਮੈਨੂੰ ਪਲੀਜ਼ ਇਹ ਦੱਸਿਆ ਜਾਵੇ ਕਿ ਤੁਹਾਡੀ ਕੋਈ ਵਾਪਸੀ ਪੋਲਿਸੀ ਹੈਗੀ ਆ ਔਰ ਜਾਂ ਫਿਰ ਰਿਟਰਨ ਪੋਲਿਸੀ ਕੋਈ ਤੁਸੀਂ ਆਪਣੇ ਔਡਰ ਦੇ ਨਾਲ ਰੱਖੀ ਹੋਈ ਆ ਇਸ ਇਸ ਪ੍ਰਤੀ ਮੈਨੂੰ ਪੂਰੀ ਜਾਣਕਾਰੀ ਦਿੱਤੀ ਜਾਵੇ ਔਰ ਕਿਰਪਾ ਕਰਕੇ ਮੇਰਾ ਇਹ ਔਡਰ ਵਾਪਿਸ ਕਰਨ ਦੀ ਕ੍ਰਿਪਾਲਤਾ ਕਰੋ ਜਿਸ ਕਰਕੇ ਕਿ ਮੈਨੂੰ ਮੇਰਾ ਔਡਰ ਔਰ ਮੇਰੇ ਪੈਸੇ ਬਰਬਾਦ ਨਾ ਹੋਣ ਔਰ ਮੈਨੂੰ ਪੂਰੀ ਜਾਣਕਾਰੀ ਦਿੱਤੀ ਜਾਏ ਧੰਨਵਾਦ ਔਰ ਮੇਰੀ ਇਸ ਅਪੀਲ ਨੂੰ ਬਹੁਤ ਹੀ ਨਿਸਚਿਤ ਤੌਰ 'ਤੇ ਦੇਖਿਆ ਜਾਵੇ ਧੰਨਿਆ ਧੰਨਵਾਦ ਜੀ